ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਯਾਦ ਆ ਜੀ ਹਾਂਜੀ ਹਾਂਜੀ ਤੁਹਾਡਾ ਨੰਬਰ ਫੀਡ ਆ ਸਾਡੇ ਕੋਲ ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਬਹੁਤ ਹੋਣਗੇ ਜੀ ਪੰਜ ਤਾਂ ਕਿੰਨੇ ਕੁ ਬੰਦਿਆਂ ਦਾ ਪ੍ਰੋਗਰਾਮ ਆ ਜੀ ਬਹੁਤ ਹੋ ਹੋਣਗੇ ਨਹੀਂ ਜੀ ਤਿੰਨ ਚਾਰ ਤਾ ਵਾਹਲਾ ਹੋਜੂ ਜੀ ਤਿੰਨ ਬਹੁਤ ਆਗਾ ਠੀਕ ਹੈ ਜੀ ਹਾਂਜੀ ਮਿਲ ਜੂ ਹਾਂਜੀ ਠੀਕ ਹੈ ਜੀ ਠੀਕ ਹੈ

ਠੀਕ ਹੈ ਠੀਕ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਮਟਰ ਸੌ ਰੁਪਏ ਜੀ ਹਾਂਜੀ ਚਲੋ ਤੁਹਾਨੂੰ ਦਸ ਵੀਹ ਰੁਪਏ ਲੈੱਸ ਕਰ ਦਾਂਗੇ ਜੀ ਕੋਈ ਨਾ ਜੀ ਪਨੀਰ ਉਂਝ ਤਾਂ ਬਾਜ਼ਾਰ 'ਚ ਚਾਰ ਸੌ ਚੱਲੀ ਜਾਂਦਾ ਤੁਹਾਨੂੰ ਸਾਢੇ ਤਿੰਨ ਸੌ ਲਾ ਦਾਂਗੇ ਠੀਕ ਆ ਜੀ ਹਾਂਜੀ ਅਤੇ ਪੈਸੇ ਗੁੱਗਲ ਪੇ ਕਰ ਦਿਓ ਜੀ ਜੇ ਕਰਨੇ ਹੋਏ ਤਾਂ ਠੀਕ ਆ ਜੀ ਠੀਕ ਆ ਜੀ ਠੀਕ ਸਾਨੂੰ ਡਰੈਸ ਲਿਖਾ ਦਿਓ ਜੀ ਜੇ ਇੱਧਰ ਕੋਈ ਆਉਂਦਾ ਹੋਇਆ ਤਾਂ ਅਸੀਂ ਪਹੁੰਚ ਵਾ ਦਾਂਗੇ ਤੁਹਾਡਾ ਸਾਮਾਨ ਠੀਕ ਆ ਜੀ ਠੀਕ ਆ ਜੀ ਠੀਕ ਆ ਜੇ ਕੋਈ ਮੁੰਡਾ ਆਉਂਦਾ ਹੋਇਆ ਤਾਂ ਵੀ ਅਸੀਂ ਸਮਾਨ ਪਹੁੰਚਾ ਦਾਂਗੇ ਤੁਹਾਡਾ ਠੀਕ ਆ ਜੀ ਓਕੇ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਕੋਈ ਨਾ ਤੁਹਾਨੂੰ ਲੈੱਸ ਕਰ ਠੀਕ ਆ ਜੀ ਉਹ ਸਭ ਤੁਹਾਨੂੰ ਵੈਸੇ ਪਾ ਦਾਂਗੇ ਫ੍ਰੀ 'ਚ ਠੀਕ ਓਕੇ